ਮੈਨੂੰ ਲਿਖਣਾ ਬਹੁਤ ਹੀ ਪਸੰਦ ਹੈ ਮੈਂ ਆਪਣੀ ਲਾਈਫ ਡਾਇਰੀ ਵਿੱਚ ਵੀ ਲਿਖਦੀ ਰਹਿੰਦੀ ਹਾਂ ਮੈਨੂੰ ਰੈਸਟੋਰੋਂਟ ਦੇ ਔਡਰ ਵੀ ਲਿਖਣੇ ਬਹੁਤ ਹੀ ਪਸੰਦ ਹਨ ਮੈਂ ਅਖਬਾਰਾਂ ਵਿੱਚ ਜੋ ਵੀ ਟੋਪਿਕ ਪੜ੍ਹਦੀ ਹਾਂ ਮੈਂ ਉਹ ਵੀ ਆਪਣੇ ਨੋਟਬੁੱਕ ਵਿੱਚ ਲਿਖ ਲੈਂਦੀ ਹਾਂ ਮੈਨੂੰ ਲਿਖਣਾ ਬਹੁਤ ਹੀ ਪਸੰਦ ਹੈ ਮੈਂ ਤਾਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਜੋ ਆਤੰਕਵਾਦੀ ਹੁੰਦੇ ਹਨ ਮੈਂ ਉਹਨਾਂ ਦੇ ਸਾਥ ਤਾਂ ਨਹੀਂ ਹਨ ਪਰ ਮੈਂ ਉਹਨਾਂ ਦੇ ਖਿਲਾਫ ਜ਼ਰੂਰ ਹਾਂ ਕਿ ਉਹ ਬੰਬ ਬੰਬ ਲੜਾਈਆਂ ਲੜੂਈਆਂ ਬਹੁਤ ਹੀ ਕਰਵਾਉਂਦੇ ਹਨ ਕਿ ਮੈਂ ਇਹਨਾਂ ਦੇ ਖਿਲਾਫ ਕੁਝ ਨਹੀਂ ਲਿਖ ਸਕਦੀ ਸੋ ਤੁਸੀਂ ਇਹਨਾਂ ਦਾ ਹੱਲ ਕਰੋ